ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਦੱਸੋ ਹਾਂਜੀ ਅੱਛਾ ਜੀ ਅੱਛਾ ਜੀ ਅੱਗੇ ਵੀ ਤੁਸੀਂ ਦਿਖਾਇਆ ਕਿਸੇ ਬੱਚਿਆਂ ਵਾਲੇ ਡਾਕਟਰ ਨੂੰ ਦਿਖਾਇਆ ਅੱਛਾ ਜੀ ਬੱਚੇ ਨੂੰ ਨਾ ਸਾਡੇ ਕੋਲ ਲੈ ਕੇ ਆਇਓ ਅਤੇ ਨਾਲੇ ਤੁਸੀਂ ਜਿਹੜੇ ਬੱਚੇ ਨੂੰ ਆਪਣੀ ਖੁਰਾਕ ਦੇਣੀ ਆ ਆਪਣੇ ਆਪ ਆਪਣੇ ਘਰ ਹੀ ਖੁਰਾਕ ਬਣਾ ਕੇ ਦੇੇਣੀ ਆ ਬਹਾਰਲੀ ਕੋਈ ਚੀਜ਼ ਨਹੀਂ ਖਿਲਾਉਣੀ ਬੱਚੇ ਨੂੰ ਅਤੇ ਨਾਲ ਬੱਚੇ ਨੂੰ ਬੱਚੇ ਨੂੰ ਪਾਰਕ ਵਗੈਰਾ ਦੇ ਵਿੱਚ ਲੈ ਕੇ ਜਾਇਆ ਕਰੋ ਬੱਚੇ ਨੂੰ ਘੁਮਾਓ ਫਿਰਾਓ ਬੱਚਿਆਂ ਨਾਲ ਥੋੜ੍ਹਾ ਜਿਹਾ ਟਾਈਮ ਆਪਣਾ ਆਪ ਟਾਈਮ ਦਿਓ ਬੱਚੇ ਨੂੰ ਹੈਨਾ ਬੱਚੇ ਨਾਲ ਗੱਲਾਂ ਬਾਤਾਂ ਕਰੋ ਅਤੇ ਬੱਚੇ ਨੂੰ ਇੱਧਰ ਉੱਧਰ ਘੁੰਮਾਓ ਬੱਚੇ ਨੂੰ ਦੇਖ ਕੇ ਬੱਚਾ ਨਾ ਦੇਖ ਕੇ ਫਿਰ ਥੋੜ੍ਹਾ ਖਾਣ ਪੀਣ ਸ਼ੁਰੂ ਕਰ ਦਿੰਦਾ ਬੱਚਾ ਖਾਣਾ ਬੱਚੇ ਨੂੰ ਬਾਹਰਲੀ ਚੀਜ਼ ਤਾਂ ਬਿਲਕੁਲ ਨਾ ਅਤੇ ਬੱਚਿਆਂ ਨੂੰ ਤੁਸੀਂ ਆਪਣੇ ਪਰੋਪਰ ਟੀਕੇ ਵਗੈਰਾ ਲਗਵਾਏ ਹੋਏ ਨੇ ਬੱਚਿਆਂ ਦੇ

ਤੁਸੀਂ ਸਾਡੇ ਇੱਥੇ ਹੋਸਪਿਟਲ 'ਚ ਇੱਕ ਵਾਰ ਬੱਚਿਆਂ ਨੂੰ ਲੈ ਕੇ ਆਇਓ ਅਤੇ ਉਸ ਤੋਂ ਫਿਰ ਤੁਹਾਨੂੰ ਕੋਈ ਟੋਨਿਕ ਵਗੈਰਾ ਵੀ ਲਿਖ ਕੇ ਦੇਵਾਂਗੇ ਹੈਨਾ ਬੱਚੇ ਨੂੰ ਉਹ ਖਿਲਾਇਓ ਜੇ ਉਹਦੇ ਨਾਲ ਵੀ ਨਹੀਂ ਫ਼ਰਕ ਪੈਂਦਾ ਤਾਂ ਫਿਰ ਆਪਾਂ ਕਿਸੇ ਹੋਰ ਡਾਕਟਰ ਦੀ ਸਲਾਹ ਲੈ ਕੇ ਤੁਹਾਨੂੰ ਦੱਸਾਂਗੇ ਨਾ ਤੇ ਬੱਚੇ ਦਾ ਖਾਣ ਪੀਣ ਦਾ ਧਿਆਨ ਬੱਚੇ ਨੂੰ ਟਾਈਮ 'ਤੇ ਸੁਲਾਉਣਾ ਬੱਚੇ ਨੂੰ ਟਾਈਮ 'ਤੇ ਨਲਾਉਣਾ ਸਭ ਕੁਛ ਕਰਨਾ ਬੱਚੇ ਵਾਸਤੇ ਜ਼ਰੂਰੀ ਹੁੰਦੀਆਂ ਗੱਲਾਂ ਨੂੰ ਇਹ ਹਾਂਜੀ ਬੱਚੇ ਨੂੰ ਇੱਕ ਤਾਂ ਮਿੱਟੀ ਦੇ ਵਿੱਚ ਵੀ ਖੇਡਣ ਦੇਣਾ ਚਾਹੀਦਾ ਬੱਚੇ ਨੂੰ ਮਿੱਟੀ ਦੇ ਵਿੱਚ ਵੀ ਬਹੁਤ ਤੱਤ ਮਿਲਦੇ ਬੱਚੇ ਨੂੰ ਖੇਡਣ ਦੇ ਨਾਲ ਹਾਂਜੀ ਮੈਮ ਬੱਚੇ ਨੂੰ ਬਾਹਰ ਲੈ ਕੇ ਜਾਓ ਗਰਾਊਂਡ ਦੇ ਵਿੱਚ ਲੈ ਜਾਓ ਪਾਰਕ ਵਿੱਚ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ ਬੱਚੇ ਨੂੰ ਬੱਚੇ ਨੂੰ ਖੁੱਲ੍ਹੀ ਹਵਾ ਦੇ ਵਿੱਚ ਲੈ ਕੇ ਜਾਓ ਜੋ ਬੱਚਾ ਇਹ ਜਿਹਾ ਹੁੰਦਾ ਨਾ ਬੋਲਦਾ ਨਹੀਂ ਕੁਛ ਖਾਂਦਾ ਨਹੀਂ ਪੀਂਦਾ ਨਹੀਂ ਬੱਚੇ ਨੂੰ ਥੋੜ੍ਹੀ ਜਿਹੀ ਵੀ ਆਪਣੇ ਵਾਤਾਵਰਨ ਦੀ ਵੀ ਮਾਹੌਲ ਦਾ ਵੀ ਫ਼ਰਕ ਪੈ ਜਾਂਦਾ ਬਹੁਤ ਬੱਚੇ ਦੇ ਓਏ ਕੋਈ ਨਾ ਤੁਸੀਂ ਇੱਕ ਵਾਰ ਬੱਚੇ ਨੂੰ ਲੈ ਕੇ ਆਓ ਕੋਈ ਦਵਾਈ ਦਿੰਦੇ ਹਾਂ ਆਪਾਂ ਦਵਾਈ ਦੇਖ ਕੇ ਨਾ ਦੇਵਾਂਗੇ ਇਹਨਾਂ ਨੂੰ ਫਿਰ ਥੋੜ੍ਹਾ ਜਿਹਾ ਖਾਣ ਪੀਣਾ ਸ਼ੁਰੂ ਕਰ ਦੂਗਾ ਬੱਚੇ ਦੇ ਨਾਲ ਹੀ ਥੋੜ੍ਹਾ ਬੱਚੇ ਜਦੋਂ ਉਹਦੇ ਪੇਟ ਦੇ ਵਿੱਚ ਹੀ ਨਹੀਂ ਕੁਝ ਜਾਊਗਾ ਤਾਂ ਬੱਚੇ ਨੇ ਬੋਲਣਾ ਕੀ ਆ ਬੱਚਾ ਖਾਊ ਪੀਊਗਾ ਬੋਲੂਗਾ ਖੇਡੂਗਾ ਹੈਨਾ ਕੋਈ ਨਾ ਤੁਸੀਂ ਇੱਕ ਵਾਰ ਸਾਡੇ ਕੋਲ ਲੈ ਕੇ ਆਓ ਬੱਚੇ ਨੂੰ ਦੇਖਦੇ ਹਾਂ ਵੀ ਕੀ ਪ੍ਰੋਬਲਮ ਹੈ ਵੀ ਬੱਚਾ ਖਾਣ ਲੱਗ ਜਾਊਗਾ ਹੈ ਨਾ ਲੈ ਕੇ ਆਇਓ ਸਾਡੇ ਕੋਲ ਦੱਸਾਂਗੇ ਕਿ

ਨੌਂ ਤੋਂ ਪੰਜ ਵਜੇ ਤੱਕ ਨੌਂ ਤੋਂ ਪੰਜ ਵਜੇ ਤੱਕ ਹਾਂਜੀ ਨੌਂ ਤੋਂ ਪੰਜ ਜਦੋਂ ਮਿਲ ਲਓ

ਨਹੀਂ ਪਰਚੀ ਕਟਵਾਉਣੀ ਪੈਣੀ ਆ ਪਹਿਲਾਂ ਹੀ ਓ ਹਾਂ ਪਰਚੀ ਕਟਵਾਉਣੀ ਪੈਣੀ ਚਲੋ ਠੀਕ ਹੈ ਜੀ ਹੈ ਨਾ ਓਕੇ ਓਕੇ